ਹੈਲੋ ਹਾਂਜੀ ਬਰਨਾਲਾ ਹਾਂਜੀ ਬਲਜੀਤ ਫਰੂਟ ਸ਼ੋਪ ਤੋਂ ਹਾਂਜੀ ਹਾਂ ਸਾਡੇ ਕੋਲ ਜੀ ਤਕਰੀਬਨ ਹਰ ਕੁਆਲਿਟੀ ਦੇ ਫਰੂਟ ਮੌਜੂਦ ਹੁੰਦੇ ਨੇਗੇ ਵੀ ਜਿਵੇਂ ਵੀ ਤੁਸੀਂ ਤੁਹਾਨੂੰ ਕਿਹੜੀ ਟੈਪ ਦੀ ਚਾਹੀਦੇ ਨੇ ਫਰੂਟ ਐਪਲ ਇੱਕ ਤਾਂ ਦੇਖੋ ਜੀ ਕਸ਼ਮੀਰੀ ਐਪਲ ਹੈਗਾ ਕਸ਼ਮੀਰ ਦਾ ਹੈਗਾ ਇੱਕ ਥੋੜ੍ਹਾ ਜਿਹਾ ਬਾਹਰੋਂ ਆਂਗਾ ਕਿ ਉਹ ਆਪਣਾ ਲਾਇਆ ਹੁੰਦਾ ਹੈਗਾ ਇੱਕ ਥੋੜੇ ਜਿਹੇ ਇਹਦੇ ਵਿੱਚ ਜਿਵੇਂ ਫਰੂਟ ਦਾ ਆਪਣੀ ਜੂਸ ਵਗੈਰਾ ਵਾਸਤੇ ਹੁੰਦੇ ਥੋੜ੍ਹੀ ਜਿਹੀ ਦਾਗੀ ਨਹੀਂ ਜਾਨੀ ਜਿੱਥੇ ਡੱਬੀ ਦੀ ਪੈਕਿੰਗ ਹੁੰਦੀ ਹੈ ਜਿੱਥੇ ਆਪਣੀ ਉਹ ਡੱਬੇ ਦੇ ਵਿੱਚ ਥੱਲੇ ਲੱਗਿਆ ਹੁੰਦਾ ਹੈਗਾ ਉਹਦੇ ਉੱਪਰ ਦਾਗ ਪੈ ਹੁੰਦੇ ਨੇ ਉਹ ਅੰਦਰੋਂ ਕੁਆਲਟੀ ਥੋੜ੍ਹੀ ਠੀਕ ਆ ਵਧੀਆ ਉਹ ਆਪੇ ਕੋਲੇ ਅੱਜ ਕੱਲ੍ਹ ਕਸ਼ਮੀਰ ਦਾ ਰਿਹਾ ਹੈਗਾ ਬਹੁਤ ਵਧੀਆ ਵਰੈਟੀ ਦਾ ਹੈਗਾ ਰਸ ਭਰਪੂਰ ਹੈਗਾ ਬਹੁਤ ਵਧੀਆ ਗਾ ਤੁਸੀਂ ਕਾ ਕਾਹਦੇ ਵਾਸਤੇ ਲੈਣਾ ਗਾ ਵੀ ਘਰ ਵਾਸਤੇ ਲੈਣਾ ਗਾ ਜਾਂ ਕੋਈ ਫੰਕਸ਼ਨ ਵਗੈਰਾ ਕਿਵੇਂ ਬ੍ਰ ਅੱਛਾ ਤੁਹਾਨੂੰ ਕਦੋਂ ਤੱਕ ਚਾਹੀਦਾ ਜੀ ਹਾਂ ਠੀਕ ਆ ਜੀ ਕਿੰਨੀ ਕੁ ਕੁਆਂਟੀ ਚਾਹੀਦੀ ਆ ਜੀ ਹਾਂਜੀ ਠੀਕ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ ਸਾਡੇ ਕੋਲ ਸਾਰਾ ਤਕਰੀਬਨ ਸਾਰਾ ਕੁਛ ਮਿਲ ਜਾਏਗਾ ਅਵੇਲਬਲ ਹੋ ਜਾਏਗਾ ਅਤੇ ਪਰ ਸਾਨੂੰ ਤੁਹਾਨੂੰ ਜਿਹੜਾ ਆਰਡਰ ਹੈਗਾ ਸਾਨੂੰ ਪਹਿਲਾਂ ਦੇਣਾ ਪਏਗਾ ਠੀਕ ਹੈ ਕਿ ਅਸੀਂ ਉਸ ਨਾਲ ਐਵਰੇਜ ਦੇ ਹਿਸਾਬ ਨਾਲ ਲਿਆਉਂਦੇ ਆਗੇ ਜੇ ਤੁਸੀਂ ਆਰਡਰ ਦੇਵੋਗੇ ਤਾਂ ਤੁਸੀਂ ਉਸ ਹਿਸਾਬ ਨਾਲ ਕੁਆਂਟੀ ਆ ਜੀ ਵੱਧ ਲੈ ਆਵਾਂਗੇ ਉਸ ਹਿਸਾਬ ਨਾਲ ਮੰਗਵਾਵਾਂਗੇ ਵੱਧ ਸਾਨੂੰ ਉਹ ਸਾਨੂੰ ਦੱਸ ਦਿਓ ਤੁਸੀਂ ਆ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੈਗੇ ਚੈੱਕ ਵੀ ਕਰ ਸਕਦੇ ਹੈਗੇ ਕੋਈ ਓਹ ਨਹੀਂ ਗਾ ਹਾਂਜੀ ਨਹੀਂ ਨਹੀਂ ਨਹੀਂ ਨਹੀਂ ਜੀ ਉਸ ਤਰ੍ਹਾਂ ਦੀ ਕੁਆਲਿਟੀ ਨਹੀਂ ਹੈਗੀ ਆਪਣਾ ਆਪਾਂ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ ਅੱਜ ਕੱਲ੍ਹ ਜਿਵੇਂ ਚੱਲਦੇ ਆ ਨਾ ਬਾਜ਼ਾਰ ਦੇ ਵਿੱਚ ਇਨਜੈਕਸ਼ਨ ਵਗੈਰਾ ਲਾ ਦਿੰਦੇ ਨੇਗੇ ਅਤੇ ਹੁਣ ਪਿੱਛੇ ਜੀ ਵੀ ਸਾਨੂੰ ਕੋਈ ਸਰ ਦੱਸ ਰਹੇ ਸੀਗੇ ਉਹ ਬਾਜ਼ਾਰ 'ਚੋਂ ਲੈ ਕੇ ਆਏ ਸੀ ਐਪਲ ਉਹ ਕਹਿੰਦੇ ਵੀ ਮੈਂ ਐਪਲ ਲਿਆ ਕੇ ਰੱਖ ਤੇ ਐਪਲ ਨੂੰ ਸਾਈਜ਼ ਬਹੁਤ ਛੋਟਾ ਸੀਗਾ ਅਤੇ ਅਤੇ ਮੇਰੇ ਨਾਲ ਕਸਟਮਰ ਦੱਸ ਰਹੇ ਸੀਗੇ ਕਹਿੰਦੇ ਵੀ ਉਹ ਦੋ ਦਿਨਾਂ ਕਹਿੰਦੇ ਆਪਣਾ ਵੈਸੇ ਪੈ ਰਹੇ ਕਹਿੰਦੇ ਉਦੋਂ ਬਾਅਦ ਜਦੋਂ ਮੈਂ ਰਸੋਈ 'ਚ ਦੇਖਿਆ ਤਾਂ ਨਾ ਸਾਈਜ਼ ਕਹਿੰਦੇ ਬਹੁਤ ਵੱਡਾ ਹੋਇਆ ਪਿਆ ਨਾਲ ਕਹਿੰਦੇ ਵੀ ਉਹ ਲਾਲ ਵੀ ਹੋਏ ਪਏ ਤਾਂ ਉਹ ਪੁੱਛਦੇ ਸੀ ਵੀ ਇਹਦਾ ਕੀ ਰੀਜਨ ਹੈਗਾ ਉਦੋਂ ਮੈਂ ਇਹੀ ਰੀਜ਼ਨ ਦੱਸਿਆ ਕਿ ਕਈ ਵਾਰ ਨਾ ਉਸ 'ਚ ਇੰਜੈਕਸ਼ਨ ਵਗੈਰਾ ਲਾਏ ਹੁੰਦੇ ਨੇਗੇ ਅਸੀਂ ਉਸੇ ਨਾਲ ਕੋਈ ਨਹੀਂ ਗਾ ਤੁਸੀਂ ਕਿੱਥੇ ਮਰਜ਼ੀ ਚੈੱਕ ਕਰਵਾ ਸਕਦੇ ਹੋਗੇ ਕੁਆ ਸਾਡਾ ਹਾਂ ਜਿਹੜਾ ਰੇਟ ਹੈਗਾ ਬਹੁਤ ਜਾਇਜ਼ ਹੋਵੇਗਾ ਉਹਦੇ ਵਿੱਚ ਅਸੀਂ ਤੁਹਾਨੂੰ ਕੋਈ ਰਿਲੈਕਸੇਸ਼ਨ ਨਹੀਂ ਕਰ ਸਕਦੇ ਜ਼ਿਆਦਾਤਰ ਬਾਕੀ ਸਾਡਾ ਕੁਆਲਿਟੀ ਵਧੀਆ ਤਾਂ ਨਹੀਂ ਬਹੁਤ ਵਧੀਆ ਸੀ ਕੁਆਲਿਟੀ ਦਿੰਦੇ ਆਂਗੀ ਸਾਰੇ ਬਰਨਾਲੇ 'ਚ ਆਪਣੀ ਦੁਕਾਨ ਬਹੁਤ ਮਸ਼ਹੂਰ ਆ ਗਈ ਤੁਸੀਂ ਆਪਦਾ ਏਰੀਆ ਸਾਰੇ ਸਪਲਾਈ ਕਰਦੇ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਕਿਹੜੀ ਪੈਲਸ ਵਾਲੇ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਨਾਂ ਦੇ ਤਾਂ ਆਪਣਾ ਮਾਲ ਜਾਂਦਾ ਹੀ ਰਹਿੰਦਾ ਹੈਗਾ ਜੀ ਆਪਣਾ ਤਕਰੀਬਨ ਉਹਨਾਂ ਕੋਲ ਸਾਰਾ ਜਾਂਦਾ ਰਹਿੰਦਾ ਉਹ ਸਾਰੀ ਕਸਟਮਰ ਭੇਜਦੇ ਨੇਗੇ ਬਿਲਕੁਲ ਜਾਂਦੀ ਹੁੰਦਾ ਨਹੀਂ ਨਹੀਂ ਨਹੀਂ ਨਹੀਂ ਨਹੀਂ ਕੁਛ ਨਹੀਂ ਹੈਗਾ ਅਸਾਂ ਇੱਕ ਲੋਕ ਸੇਵਾ ਕਰ ਰਹੇ ਹਾਂਗੇ ਸਹੀ ਹੈਗਾ ਅਤੇ ਕੋਈ ਕਮਿਸ਼ਨ ਨਹੀਂ ਹੈਗਾ ਇਹਨਾਂ ਦਾ ਉਹ ਸਾਨੂੰ ਕੁਆਲਟੀ ਵਧੀਆ ਹੁੰਦੀ ਤਾਂ ਆ ਕੇ ਸਾਡੇ ਆਪਾਂ ਤੋਂ ਲੈ ਲੈਂਦੇ ਨੇਗੇ ਅਤੇ ਆਪਣੇ ਕੁਆਲਿਟੀ ਵਧੀਆ ਹੁੰਦੀ ਹੈ ਤਾਂ ਕਰਕੇ ਹੈ ਓਕੇ ਓਕੇ ਸਰ ਠੀਕ ਹੈ ਜੀ ਓਕੇ ਓਕੇ ਓਕੇ ਓਕੇ ਓਕੇ